ਜੇਕਰ ਅਸੀਂ ਪਹਿਲੇ ਨੰਬਰ 'ਤੇ ਕਹੀਏ ਕਿ ਯੋਗਾ ਨਾਲ ਭਾਈਚਾਰੇ ਭਾਵਨਾ ਵੀ ਜਗਦੀ ਹੈ ਇਕੱਠੇ ਬਹਿਣ ਦਾ ਮੌਕਾ ਮਿਲਦਾ ਹੈ ਇਕੱਠੇ ਬਹਿ ਕੇ ਕਸਰਤ ਯੋਗਾ ਕਰਨ ਦਾ ਮਤਲਬ ਮੌਕਾ ਮਿਲਦਾ ਹੈ ਅਤੇ ਅਗਰ ਤੁਸੀਂ ਯੋਗ ਅਵਸਥਾ ਵਿੱਚ ਜਾਂ ਕਿਤੇ ਬੈਠਿਆਂ ਕਿਤੇ ਕੋਈ ਗਲਤੀ ਹੁੰਦੀ ਆ ਤਾਂ ਜੋ ਪੁੱਛਿਆ ਜਾ ਸਕਦਾ ਹੈ ਅਤੇ ਜੋ ਇਹਦਾ ਮੇਨ ਅਸਲ ਮਤਲਬ ਇਹ ਹੈ ਕਿ ਬੰਦਾ ਤੰਦਰੁਸਤ ਰਹਿੰਦਾ ਸਵੇਰੇ ਜਲਦੀ ਉੱਠਦਾ ਹੈ ਆਪਣੇ ਟਾਈਮ ਦਾ ਪਾਬੰਦ ਹੁੰਦਾ ਹੈ ਅਤੇ ਰੂਟੀਨ ਦੇ ਵਿੱਚ ਜੇ ਕੀਤਾ ਜਾਵੇ ਤਾਂ ਇਹਦੇ ਵਿੱਚ ਸਰੀਰ ਦੀ ਫਿਟਨੈਸ ਦੁਆਰਾ ਸਰੀਰ ਤੰਦਰੁਸਤ ਰਹਿੰਦਾ ਹੈ ਨਰੋਆ ਰਹਿੰਦਾ ਹੈ ਨਿਰੋਗੀ ਰਹਿੰਦਾ ਹੈ ਅਤੇ ਇਹ ਜਾਨ ਪ੍ਰਤੀ ਇਹਦੇ ਨਾਲ ਜੇ ਕੋਈ ਚਾਰ ਦੋਸਤ ਜਾਂ ਭੈਣ ਭਰਾ ਬਹਿ ਕੇ ਕਰਦੇ ਹਨ ਅਤੇ ਉਹਦੇ ਨਾਲ ਆਪਸੀ ਵਿਚਾਰ ਵਟਾਂਦਰਾ ਹੋਣ ਕਰਕੇ ਉਹਦੇ ਨਾਲ ਦੋਸਤੀ ਵੀ ਗੂੜ੍ਹੀ ਹੁੰਦੀ ਜਾਂਦੀ ਹੈ ਕਿਤੇ ਵਿੱਚ ਨਾ ਪਤਾ ਲੱਗੇ ਬੰਦਾ ਪੁੱਛ ਸਕਦਾ ਜੇ ਕਿਸੇ ਨੂੰ ਨਾ ਪਤਾ ਲੱਗੇ ਤਾ ਉਹਨੂੰ ਦੱਸ ਸਕਦਾ ਯੋਗਾ ਦੇ ਨਾਲ ਵੈਸੇ ਦੇਖਿਆ ਜਾਏ

ਭਾਈਚਾਰਕ ਭਾਵਨਾ ਵੀ ਵਧਦੀ ਹੈ ਜਿਹਦੇ ਤੌਰ 'ਤੇ ਇੱਕ ਦੂਸਰੇ ਨਾਲ ਵਿਸ਼ਵਾਸ ਬਣਦਾ ਹੈ ਸਾਂਝ ਵਧਦੀ ਹੈ ਪ੍ਰੇਮ ਮੁਹੱਬਤ ਬਣਦਾ ਹੈ ਅਤੇ ਯੋਗਾ ਵਧੀਆ ਚੀਜ਼ ਹੈ ਬਾਕੀ ਯੋਗਾ ਕਰਨਾ ਵੀ ਹਰ ਉਮਰ 'ਚ ਚਾਹੀਦਾ ਹੈ ਨੌਜਵਾਨ ਵੀ ਕਰਨ ਫਾਇਦਾ ਹੈ ਜੇਕਰ ਕੋਈ ਅਧਖੜ ਕਰਦਾ ਉਹਨੂੰ ਵੀ ਫਾਇਦਾ ਪਰ ਇਹ ਇੱਕ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਸਰੀਰ ਦੀਆਂ ਦਰਦਾਂ ਥਕਾਵਟ ਇਹ ਸਭ ਨੂੰ ਮੇਟਣ ਕਰਦਾ ਹੈ ਇਹਦੇ ਨਾਲ ਪੇਟ ਦੀ ਗੈਸ ਜੋੜਾਂ ਦਾ ਦਰਦ ਕਮਰ ਦਰਦ ਥਕਾਵਟ ਬਲੱਡ ਪ੍ਰੈਸ਼ਰ ਅੱਖਾਂ ਦੀ ਰੋਸ਼ਨੀ ਸਭ ਠੀਕ ਹੁੰਦੇ ਹਨ ਅਤੇ ਯੋਗਾ ਇੱਕ ਬਹੁਤ ਵਧੀਆ ਚੀਜ਼ ਹੈ